ਸ਼ੋਸ਼ਲ ਮੀਡੀਆ 'ਤੇ ਮੇਰੇ ਖਿਆਲ ਨਾਲ ਕਿ ਜਿਵੇਂ ਕਿ ਇੰਸਟਾਗ੍ਰਾਮ ਫੇਸਬੁੱਕ ਅਤੇ ਵਟਸਐਪ ਹੋਰ ਜੀਮੇਲ ਆਈਡੀਆਂ ਹਨ ਕਿਉਂਕਿ ਇਨ੍ਹਾਂ ਦੀ ਪ ਪਾਲਣਾ ਬਹੁ ਬਹੁਤ ਵਧੀਆ ਕਰਦਾ ਹਾਂ ਕਿ ਪੋਸਟਮ ਪ ਸ਼ ਸ਼ੋਸ਼ਲ ਮੀਡੀਆ 'ਤੇ ਕਿਉਂਕਿ ਖਾਤੇ ਮੈਂ ਇੰਨਾ ਜ਼ਿਆਦਾ ਇੰਟਰੈਸਟ ਨਹੀਂ ਹੈਗਾ ਇੰਨਾ ਪਰ ਫਿਰ ਵੀ ਮੇਰੇ ਖਾਤੇ ਹੈ ਮੈਂ ਵਧੀਆ ਦੇਖਦਾ ਹਾਂ ਕੀ ਮੈਨੂੰ ਵਧੀਆ ਲੱਗ ਰਿਹਾ ਕੀ ਕੋਈ ਜਾਣਕਾਰੀ ਮਿਲਦੀ ਹੈ ਪੂਰੀ ਦੁਨੀਆ ਦੀ ਇਸ ਕਰਕੇ ਮੈਂ ਇਹ ਇਹਨਾਂ ਦੀ ਪਾਲਣਾ ਚੰਗੇ ਤਰੀਕੇ ਨਾਲ ਕਰਦਾ ਹਾਂ